ਹਾਂਜੀ ਮੈਨੂੰ ਭੰਗੜਾ ਪਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਮੈਨੂੰ ਭੰਗੜੇ ਦਾ ਬਹੁਤ ਸ਼ੌਂਕ ਹੈ ਮੈਂ ਆਪਣੀ ਜੋ ਵੀ ਖੁਸ਼ੀ ਨੂੰ ਵਿਅਕਤ ਕਰਨਾ ਹੁੰਦਾ ਹੈ ਉਹ ਮੈਂ ਭੰਗੜੇ ਦੇ ਨਾਲ ਹੀ ਆਪਣੀ ਖੁਸ਼ੀ ਨੂੰ ਜਾਹਿਰ ਕਰਦੀ ਹਾਂ ਮੈਨੂੰ ਯਾਦ ਹੈ ਜਦੋਂ ਮੇਰੀ ਮਾਤਾ ਜੀ ਦਾ ਜਨਮ ਦਿਨ ਸੀ ਅਸੀਂ ਉਹਨਾਂ ਨੂੰ ਇੱਕ ਪਾਰਟੀ ਦਿੱਤੀ ਸੀ ਅਤੇ ਪਾਰਟੀ ਦੇ ਵਿੱਚ ਅਸੀਂ ਸਾਰੇ ਭੈਣ ਭਰਾਵਾਂ ਨੇ ਉਹਨਾਂ ਨੂੰ ਭੰਗੜਾ ਪਾ ਕੇ ਇੱਕ ਸਰਪ੍ਰਾਈਜ਼ ਦਿੱਤਾ ਸੀ ਅਤੇ ਮੇਰੇ ਮਾਤਾ ਜੀ ਨੋਰਮਲੀ ਮਤਲਬ ਕਿ ਨੱਚਦੇ ਕੁੱਦਦੇ ਨਹੀਂ ਹਨ ਪਰ ਜਦੋਂ ਉਹਨਾਂ ਨੇ ਸਾਡੀ ਪਰਫੋਰਮੈਂਸ ਦੇਖੀ ਤਾਂ ਉਹਨਾਂ ਤੋਂ ਵੀ ਨੱਚਣ ਤੋਂ ਬਿਨਾਂ ਰਿਹਾ ਨਹੀਂ ਗਿਆ ਅਤੇ ਅਸੀਂ ਉਧਰ ਅਸੀਂ ਆਪਣੀ ਮਾਤਾ ਜੀ ਨੂੰ ਪਹਿਲੀ ਵਾਰ ਸਾਡੇ ਨਾਲ ਭੰਗੜਾ ਪਾਉਂਦੇ ਦੇਖਿਆ ਅਤੇ ਉਹਨਾਂ ਦਾ ਵੀ ਇਹ ਟੈਲੈਂਟ ਮਤਲਬ ਕਿ ਉਹਨਾਂ ਦੀ ਸਾਡਾ ਭੰਗੜਾ ਦੇਖ ਕੇ ਉਹਨਾਂ ਦਾ ਵੀ ਟੈਲੈਂਟ ਬਾਹਰ ਆ ਗਿਆ ਅਤੇ ਉਹ ਸਾਡੇ ਲਈ ਇਕ ਬਹੁਤ ਹੀ ਯਾਦਗਾਰੀ ਅਨੁਭਵ ਹੈ ਕਿ ਮਾਤਾ ਜੀ ਨੇ ਸਾਡੀ ਖੁਸ਼ੀ ਦੇ ਵਿੱਚ ਹੀ ਆਪਣੀ ਖੁਸ਼ੀ ਨੂੰ ਵਿਅਕਤ ਕੀਤਾ ਅਤੇ ਬਹੁਤ ਹੀ ਜ਼ਿਆਦਾ ਸਾਡੇ ਲਈ ਖੁਸ਼ੀ ਵਾਲਾ ਦਿਨ ਸੀ ਅਤੇ ਅਸੀਂ ਉਸ ਨੂੰ ਆਪਣੇ ਮਤਲਬ ਕਿ ਕੈਮਰਿਆਂ ਦੇ ਵਿੱਚ ਰਿਕਾਰਡ ਕੀਤਾ ਅਤੇ ਜਦੋਂ ਵੀ ਅਸੀਂ ਸਾਰੇ ਭੈਣ ਭਰਾ ਮਾਤਾ ਜੀ ਇਕੱਠੇ ਬੈਠਦੇ ਹਾਂ ਅਤੇ ਉਹ ਵੀਡੀਓ ਨੂੰ ਦੇਖ ਕੇ ਬਹੁਤ ਹੀ ਖੁਸ਼ ਹੁੰਦੇ ਹਾਂ ਇਹ ਸਾਡੇ ਲਈ ਬਹੁਤ ਹੀ ਯਾਦਗਾਰੀ ਇੱਕ ਅਨੁਭਵ ਸੀ ਥੈਂਕ ਧੰਨਵਾਦ ਜੀ